ਜੇਕਰ ਅਸੀਂ ਭੰਗੜੇ ਦੇ ਆਮ ਸਟੈਪ ਦੀ ਗੱਲ ਕਰੀਏ ਤਾਂ ਉਸਦੇ ਵਿੱਚ ਝੂਮਰ ਲੁੱਡੀ ਗਿੱਧਾ ਜੁੱਲੀ ਦੰਕਾਰਾ ਧਮਾਲ ਸੰਮੀ ਕਿੱਕਲੀ ਅਤੇ ਗੱਤਕਾ ਜਿਹੜੇ ਇਹੋ ਜਿਹੇ ਸਟੈਪ ਹਨ ਜਿਹੜੇ ਸਾਡੇ ਪੰਜਾਬੀ ਸੱਭਿਆਚਾਰ ਦੇ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ ਇਨ੍ਹਾਂ ਸਟੈਪ ਨੂੰ ਕਰਕੇ ਅਸੀਂ ਬਹੁਤ ਜਸ਼ਨ ਮਨਾ ਸਕਦੇ ਹਾਂ ਜੀ ਥੈਂਕਿ ਊ